ਹੈਲੋ ਹੈਲੋ ਹਾਂਜੀ ਵੀਰੇ ਜਿੰਦਲ ਹੈਂਡਲੂਮ ਤੋਂ ਬੋਲਦੇ ਹੋ ਸਤਿ ਸ਼੍ਰੀ ਅਕਾਲ ਭਾਜੀ ਹੋਰ ਕਿਵੇਂ ਹੋ

ਵੀਰੇ ਸਾਨੂੰ ਮੋਸਟਲੀ ਤਾਂ ਬਰੈਂਡਡ ਹੀ ਚਾਹੀਦਾ ਵਾ ਬਾਕੀ ਵਧੀਆ ਤੋਂ ਵਧੀਆ ਮਤਲਬ ਹੋਵੇ ਤਾਂ ਸਮਾਨ ਉੰਨਾ ਵਧੀਆ ਹੈ ਹਾਂਜੀ ਹਾਂਜੀ ਬਾਕੀ ਮੈਨੂੰ ਕੁਛ ਦੱਸ ਦਓ ਕਿੱਦਾਂ ਮਤਲਬ ਅਸੀਂ ਆਈਏ ਅਤੇ ਕਦੋਂ ਆਈਏ ਕਿਵੇਂ ਮਤਲਬ ਦੇਖ ਲਓ ਤੁਸੀਂ ਆਪ ਹੀ ਮੰਨ ਲਓ ਬਲਕ 'ਚ ਹੀ ਚੁੱਕਣਾ ਅਸੀਂ ਮਤਲਬ ਅਸੀਂ ਥੋੜ੍ਹਾ ਜ਼ਿਆਦਾ ਹੀ ਸਮਾਨ ਚੁੱਕਣਾ ਵਾ ਕਿਓਂਕਿ ਕੁੜੀ ਦੇ ਸਾਰੀ ਮਾਸੀਆਂ ਨੂੰ ਲਾਉਣਾ ਅਤੇ ਸੋਹਰੇ ਵੀ ਸਮਾਨ ਲਾਉਣਾ ਉਹਨਾਂ ਦੀ ਅਸੀਂ ਤਾਂ ਦੇਖ ਲਓ ਤੁਸੀਂ ਇੱਕ ਤਾਂ ਕੁੜੀ ਦੇ ਘੱਟੋ ਘੱਟ ਦਸ ਅਸੀਂ ਸੂਟ ਬਣਾਉਣੇ ਹੈ ਆਪਣੀ ਅਤੇ ਬਾਕੀ ਸਾਰੀਆਂ ਨੂੰ ਸ਼ੋਲ ਲਾਉਣੀਆਂ ਘੱਟੋ ਘੱਟ ਦਸ ਪੰਦਰ੍ਹਾਂ ਤਾਂ ਸ਼ੋਲਾਂ ਲੱਗਣ ਗੀਆਂ ਸਾਡੀਆਂ ਪਸ਼ਮੀਨਾ ਅਤੇ ਤੁਸੀਂ ਜੈਕਟਾਂ ਹੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਬਾਕੀ ਬਾਕੀ ਅਸੀਂ ਹਾਂਜੀ ਹਾਂਜੀ ਬਾਕੀ ਥੋੜ੍ਹਾ ਕੁੜੀ ਨੂੰ ਸ਼ਗਨ 'ਤੇ ਸ਼ਗਨ ਵਾਲੇ ਦਿਨ ਟਾਵਲ ਵੀ ਲਾਉਣੇ ਹੈ ਅਤੇ ਤੁਹਾਡੇ ਕੋਲ ਉਹ ਵੀ ਮਿਲ ਜਾਣਗੇ ਨਾ ਆਪਣੇ ਓਕੇ ਓਕੇ ਹਾਂਜੀ ਹਾਂਜੀ ਦੇਖੋ ਜੀ ਦੇਖੋ ਬੰਦਿਆਂ ਲਈ ਤਾਂ ਅਸੀਂ ਜ਼ਿਆਦਾਤਰ ਇਹ ਹੀ ਕਹਿੰਦੇ ਆ ਅੱਜ ਕੱਲ੍ਹ ਤਾਂ ਆਡੀਡਸ ਕੰਪਨੀ ਚੱਲਦੀ ਅਤੇ ਮੌਂਟੀਕਾਰਲੋ ਚੱਲਦੀ ਆ ਜੇ ਇਹਨਾਂ ਦਾ ਮਿਲ ਜੇ ਤਾਂ ਵਧੀਆ ਹੈ ਠੀਕ ਹੈ ਬਾਕੀ ਤੁਸੀਂ ਥੋੜ੍ਹਾ ਪ੍ਰੈਫਰ ਕਰ ਦਿਓ ਦੱਸ ਦਿਓ ਕੁਛ ਦੇਖੋ ਸਾਈਜ਼ ਸਾਨੂੰ ਸਾਰੇ ਚਾਹੀਦੇ ਲਗਭਗ ਐੱਲ ਵੀ ਚਾਹੀਦਾ ਐਕਸਲ ਵੀ ਚਾਹੀਦਾ ਡਬਲ ਐਕਸਲ ਵੀ ਚਾਹੀਦਾ ਤੁਸੀਂ ਜ਼ਿਆਦਾਤਰ ਸਮਝ ਲਓ ਥ੍ਰੀ ਐਕਸਲ ਦੇ ਸਾਨੂੰ ਜ਼ਿਆਦਾ ਚਾਹੀਦੇ ਨੇ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਕੁਛ ਸਾਨੂੰ ਦੱਸ ਦਓ ਹੂੰ ਹੂੰ ਸੂਟ ਤੁਸੀਂ ਮੰਨ ਹੀ ਲਓ ਕਿ ਲੱਗ ਹੀ ਜਾਣਗੇ ਦੱਸ ਪੰਦਰ੍ਹਾਂ ਸੂਟ ਤਾਂ ਕੁੜੀ ਦੇ ਹੀ ਉਹ ਤਾਂ ਭਾਰੀ ਬਨਵਾਵਾਂਗੇ ਅਸੀਂ ਅਤੇ ਵਰਕ ਵਾਲੇ ਹੋਣ ਥੋੜ੍ਹੇ ਵਧੀਆ ਅਤੇ ਬਾਕੀ ਨੌਰਮਲ ਸੂਟ ਵੀ ਲਵਾਂਗੇ ਥੋੜ੍ਹੇ ਬਹੁਤ ਠੀਕ ਹੈ ਤਾਂ ਤੁਸੀਂ ਦੇਖ ਲਿਓ ਅਤੇ ਕਿਵੇਂ ਸੈਟਿੰਗ ਕਰਨੀ ਹੁਣ ਹੂੰ ਹਾਂਜੀ ਹਾਂਜੀ ਅੱਛਾ ਤੇ ਅ ਦੋ ਕਰ ਦੱਸੋ ਮੈਨੂੰ ਵਿਜ਼ਿਟ ਕਰਾਂ ਮੈਨੂੰ ਥੋੜ੍ਹਾ ਬਹੁਤ ਟੈਮ ਟੂਮ ਦੱਸੋ ਅਤੇ ਥੋੜ੍ਹਾ ਬਹੁਤ ਰੇਟ ਦੱਸੋ ਹੁਣ ਕੀ ਲਾਓਂਗੇ ਹੁਣ ਐਨਾ ਬਲਕ 'ਚ ਚੁੱਕਣਾ ਅੱਛਾ ਅੱਛਾ ਫੇਰ ਵੀ ਕੋਈ ਜੈਨੂਅਨ ਦੱਸਿਓ ਤੁਸੀਂ ਸਹੀ ਲਾਇਓ ਹਾਂਜੀ ਹਾਂਜੀ ਓਕੇ ਓਕੇ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਡੇ ਕੋਲ ਹਾਂਜੀ ਤੁਹਾਡੇ ਕੋਲ ਭਾ ਭਾਜੀ ਪੈਂਟ ਕੋਟ ਵੀ ਹੁੰਦੇ ਨੇ ਬੰਦਿਆਂ ਦੇ ਉੱਦਾਂ ਅੱਛਾ ਅਤੇ ਉਨ੍ਹਾਂ ਦੇ ਵੀ ਕੀ ਸਿਲਾਈ ਹੁੰਦੀ ਕਿ ਰੈਡੀਮੇਟ ਹੀ ਮਿਲਦੇ ਆਪਣੇ ਕੋਲ ਅੱਛਾ ਜੇ ਮਤਲਬ ਜੇ ਮੈਂ ਆਪਣੇ ਲਈ ਸੋਚਦਾ ਸੀ ਕਿ ਤੁਹਾਡੇ ਕੋਲ ਹੀ ਦੇਖਲਾਂਗੇ ਫਿਰ ਅਸੀਂ ਅਤੇ ਮੈਨੂੰ ਦੱਸ ਦਿਓ ਹਾਂਜੀ ਮਤਲਬ ਚਾਰ ਫੰਕਸ਼ਨ ਨੇ ਆਪਣੇ ਤੇਅ ਇੱਕ 'ਚ ਮੈਂ ਪਠਾਨੀ ਪਾਉਣਾ ਅਤੇ ਇੱਕ 'ਚ ਮੈਂ ਕੋਟ ਪੈਂਟ ਵਿਆਹ 'ਤੇ ਅਤੇ ਹਾਂਜੀ ਹਾਂਜੀ ਹਾਂਜੀ ਬਾਕੀ ਕੋਕਟੇਲ ਪਾਰਟੀ ਰੱਖੀ ਪਤਾ ਨਹੀ ਕੀ ਬੱਚਿਆਂ ਨੇ ਰੱਖੀ ਕੋਈ ਅਤੇ ਉਹਦੇ ਵਿੱਚ ਜੈਕਟ ਅਤੇ ਪਤਾ ਨਹੀਂ ਜੈਕਟ ਬੈਲਟ ਪਤਾ ਨਹੀਂ ਕਹਿੰਦੇ ਨੇ ਪਵਾਉਣੀ ਹੈ ਪਤਾ ਨਹੀਂ ਕੋਈ ਅਲੱਗ ਜਿਹੇ ਕੱਪੜੇ ਹੁੰਦੇ ਕਹਿੰਦੇ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਅਤੇ ਹੋਰ ਬਾਕੀ ਆਹੀ ਸੀ ਸਮਾਨ ਮੇਨ ਤਾਂ ਬਾਕੀ ਤੁਸੀਂ ਦੇਖ ਲਿਓ ਮੈਨੂੰ ਦੱਸ ਦਿਓ ਅਤੇ ਕੋਈ ਮੁੰਡਾ ਭਿਜਵਾ ਦਓਗੇ ਸਮਾਨ ਤੁਸੀਂ ਆਪੇ ਭਿਜਵਾ ਦਓਗੇ ਕਿ ਸਾਨੂੰ ਆਪ ਹੀ ਫਿਰ ਕਰਨਾ ਪੈਣਾ ਹਾਂਜੀ ਹਾਂਜੀ ਨਹੀਂ ਵਿਜ਼ਿਟ ਤਾਂ ਸਰ ਮੈਂ ਆਊਂਗਾ ਕਰਨ ਤੁਹਾਡੇ ਕੋਲੋਂ ਤੁਸੀਂ ਮੈਨੂੰ ਮੈਂ ਇੱਕ ਵਾਰੀ ਆਊਂਗਾ ਤੁਹਾਡੇ ਕੋਲ ਵਿਜ਼ਿਟ ਮ ਕਰਨ ਸਾਰੇ ਫਿਰ ਫ਼ੈਮਿਲੀ ਲੈ ਕੇ ਆਵਾਂਗੇ ਸਾਨੂੰ ਕੋਈ ਪ੍ਰੈਫਰ ਦਾ ਟਾਈਮ ਦੱਸ ਦਿਓ ਜਿਸ 'ਚ ਥੋੜ੍ਹਾ ਜਿਹਾ ਸਟੋਰ ਜਿਵੇਂ ਕੰਮ ਥੋੜ੍ਹਾ ਘੱਟ ਹੋਵੇ ਉਸ ਟੈਮ 'ਤੇ ਅਸੀਂ ਆ ਜਾਈਏ ਅਤੇ ਉਦੋਂ ਸਾਰੇ ਠੀਕ ਹੈ ਜੀ ਠੀਕ ਹੈ ਚਲੋ ਠੀਕ ਹੈ ਠੀਕ ਠੀਕ ਹੈ ਜੀ ਓਕੇ ਭਾਜੀ ਓਕੇ ਜੀ ਓਕੇ ਓਕੇ ਓਕੇ ਰੱਬ ਰਾਖਾ